ਅੱਜ ਕੱਲ੍ਹ ਮੈਂ ਮਤਲਬ ਕਾ ਬਹੁਤ ਗਾਇਕ ਹੈਗੇ ਨੇ ਜਿਹੜਾ ਜਿਹਨਾਂ ਨੂੰ ਮਤਲਬ ਇੱਦਾਂ ਲਾਈਵ ਸੁਣਿਆ ਹੈਗਾ ਜਿੱਦਾਂ ਉੱਥੇ ਮੇਰਾ ਐਮ ਐਸ ਸੀ ਟਾਈਮ ਪੋਸਟਰ ਗ੍ਰੈਜੂਏਸ਼ਨ ਟਾਈਮ ਨੂੰ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ੍ਹ ਹੁੰਦਾ ਨਾ ਵੀ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਉੱਤੇ ਆਪਾਂ ਐਂ ਗਾਇਕਾਂ ਨੂੰ ਸੱਦ ਲਿਆ ਜਾਂਦਾ ਤਾਂ ਮੈਂ ਗੁਰਨਾਮ ਭੁੱਲਰ ਹੋ ਗਿਆ ਸਤਿੰਦਰ ਸਰਤਾਜ ਹੋ ਗਿਆ ਕੁਲਵਿੰਦਰ ਬਿੱਲਾ ਮਤਲਬ ਕਈ ਇੱਦਾਂ ਦੇ ਹੋਰ ਵੀ ਹੈਗੇ ਨੇ ਗਾਇਕ ਜਿਹਨਾਂ ਨੂੰ ਮੈਂ ਲਾਈਵ ਸੁਣਿਆ ਤਾਂ ਜੇ ਮੈਂ ਆਪਦੇ ਅਨੁਭਵ ਦੀ ਗੱਲ ਕਰਾਂ ਸਭ ਤੋਂ ਪਸੰਦੀਦਾ ਮੇਰਾ ਗਾਇਕ ਹੈਗਾ ਜਿਹੜਾ ਉਹ ਹੈਗਾ ਸਤਿੰਦਰ ਸਰਤਾਜ ਅਤੇ ਮੈਂ ਮਤਲਬ ਆਪਦੇ ਆਪ ਨੂੰ ਬਹੁਤ ਮਤਲਬ ਮਤਲਬ ਚੰਗਾ ਉਹ ਮਤਲਬ ਬਲੈਸਡ ਮੰਨਦੀ ਹਾਂ ਵੀ ਮੈਂ ਉਹਨਾਂ ਨੂੰ ਡਾਕਟਰ ਸਤਿੰਦਰ ਸਰਤਾਜ ਨੂੰ ਮੈਂ ਲਾਈਵ ਸੁਣਿਆ ਤਾਂ ਮੇਰਾ ਉਹ ਬਹੁਤ ਵਧੀਆ ਹੀ ਅਨੁਭਵ ਸੀਗਾ ਮਤਲਬ ਜਿੱਦਾਂ ਕਿ ਸਾਰੇ ਹੀ ਜਾਣਦੇ ਹਾਂ ਉਹ ਡਾਕਟਰ ਜਿਹੜੇ ਸਤਿੰਦਰ ਸਰਤਾਜ ਆ ਉਹਨਾਂ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਮਤਲਬ ਸਤਿਕਾਰਿਆ ਜਾਂਦਾ ਚਾਹੇ ਉਹ ਬੱਚਾ ਹੋਵੇ ਚਾਹੇ ਇੱਕ ਬਜ਼ੁਰਗ ਹੋਵੇ ਚਾਹੇ ਆਪਣੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਹਰ ਤਰ੍ਹਾਂ ਦੇ ਦੇਖੋ ਸੰਗੀਤ ਉਹਨਾਂ ਨੇ ਗਾਇਆ ਹੈਗਾ ਅਤੇ ਉਹ ਹਰ ਮਤਲਬ ਮੈਂ ਉਹਨਾਂ ਦਾ ਕਦੇ ਵੀ ਕੋਈ ਨੈਗੇਟਿਵ ਕਮੈਂਟ ਜਾਂ ਕੋਈ ਹੇਟਰ ਕੋਈ ਵੀ ਨਹੀਂ ਉਹਨਾਂ ਦਾ ਦੇਖਿਆ ਹੈਗਾ ਤਾਂ ਉਹਨਾਂ ਦਾ ਮਤਲਬ ਵੀ ਮੈਨੂੰ ਬਹੁਤ ਪਸੰਦ ਆ ਉਹਨਾਂ ਦਾ ਜਿਹੜਾ ਸੰਗੀਤ ਹੈ ਉਹ ਸੱਭਿਆਚਾਰਕ ਉਹਦੇ ਨਾਲ ਜੁੜਿਆ ਹੋਇਆ